ਭੰਗੜਾ ਭੰਗੜੇ ਦਾ ਨਾਮ ਸੁਣ ਕੇ ਹੀ ਜੋਸ਼ ਆ ਜਾਂਦਾ ਅੱਜ ਦੇ ਟਾਈਮ 'ਤੇ ਲੋਕ ਅਲੱਗ ਅਲੱਗ ਤਰੀਕੇ ਨਾਲ ਆਪਣਾ ਵਜ਼ਨ ਘਟਾਉਣ ਲਈ ਕੋ ਬਹੁਤ ਸਾਰੀਆਂ ਚੀਜ਼ਾਂ ਕਰਦੇ ਹਨ ਕੁਛ ਲੋਕ ਜਿਮ ਜਾਂਦੇ ਆ ਕੁਛ ਲੋਕ ਯੋਗਾ ਕਰਦੇ ਆ ਕੁਛ ਲੋਕ ਘਰ ਹੀ ਗਾਣੇ ਲਗਾ ਕੇ ਨੱਚਣਾ ਟੱਪਣਾ ਸ਼ੁਰੂ ਕਰ ਦਿੰਦੇ ਆ ਭੰਗੜਾ ਐਰੋਬਿਕਸ ਵੀ ਇੱਕ ਕਾਰਡੀਓ ਕਹਿ ਸਕਦੇ ਹਾਂ ਉਹਨੂੰ ਕਾਰਡੀਓ ਕਸਰਤ ਹੈ ਜਿਹਦੇ ਨਾਲ ਬੰਦਾ ਆਪਣਾ ਵਜ਼ਨ ਘਟਾ ਸਕਦਾ ਅੱਜ ਕੱਲ੍ਹ ਲੋਕ ਇਹ ਬਹੁਤ ਚਲਣ ਦੇ ਵਿੱਚ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਇਹਦੇ ਨਾਲ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਅੱਛੀ ਕਸਰਤ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਸਰੀਰ ਦਾ ਪੂਰਾ ਜੋਸ਼ ਲਗਾ ਕੇ ਜੋਸ਼ ਲਗਾ ਕੇ ਵਜ਼ਨ ਨੂੰ ਘਟਾਇਆ ਜਾ ਸਕਦਾ ਹੈ ਇਸ ਲਈ ਸਾਨੂੰ ਚਾਹੀਦਾ ਹੈ ਵੀ ਸਰੀਰਕ ਐਕਸਰਸਾਈਜ਼ ਕਸਰਤਾਂ ਸਾਨੂੰ ਕਰਦੇ ਰਹਿਣਾ ਚਾਹੀਦਾ ਜਿਹਦੇ ਨਾਲ ਆਪਾਂ ਤੰਦਰੁਸਤ ਰਹੀਏ ਅਤੇ ਭੰਗੜਾ ਐਰੋਬਿਕਸ ਦੇ ਕੋਰੀਓਗ੍ਰਾਫੀ ਦੇ ਲਈ ਇੱਕ ਵਧੀਆ ਜੋਸ਼ੀਲਾ ਗਾਣਾ ਬੰਦਾ ਇਸਤੇਮਾਲ ਕਰ ਸਕਦਾ ਉਹਦੇ ਉੱਤੇ ਭੰਗੜੇ 'ਤੇ ਬਹੁਤ ਹੀ ਵਧੀਆ ਵਧੀਆ ਸਟੈਪ ਪੰਜਾਬ ਦਾ ਤਾਂ ਭੰਗੜੇ ਦਾ ਨਾਮ ਸੁਣ ਕੇ ਲੋਕਾਂ ਦੇ ਵਿੱਚ ਇੰਨਾ ਜੋਸ਼ ਆ ਜਾਂਦਾ ਕਿ ਲੋਕ ਨੱਚਦੇ ਨੇ ਟੱਪਦੇ ਨੇ ਅਤੇ ਖੁਸ਼ੀ ਨਾਲ ਭਰ ਜਾਂਦੇ ਨੇ ਅਤੇ ਫਿਰ ਸਾਨੂੰ ਵਧੀਆ ਗਾਣਾ ਲਗਾ ਕੇ ਅਤੇ ਉਹਦੇ ਉੱਤੇ ਭੰਗੜੇ ਦੇ ਕੁਝ ਜੋਸ਼ੀਲੇ ਸਟੈਪ ਜਿਵੇਂ ਕੈਂਚੀ ਹੋ ਗਿਆ ਅਤੇ ਹੱਥਾਂ ਨੂੰ ਅੱਗੇ ਪਿੱਛੇ ਮਾਰਨਾ ਇੱਦਾਂ ਕਰਕੇ ਅਤੇ ਹੋਰ ਭੰਗੜੇ ਦੇ ਅਲੱਗ ਅਲੱਗ ਸਟੈਪ ਨੂੰ ਇਸਤੇਮਾਲ ਕਰਕੇ ਅਸੀਂ ਇਹ ਗਾਣੇ 'ਤੇ ਨੱਚ ਸਕਦੇ ਹਾਂ ਜਿੰਨਾਂ ਅਸੀਂ ਜ਼ੋਰ ਲਗਾਵਾਂਗੇ ਉਨਾ ਸ ਸਰੀਰ ਦੀ ਇਹ ਵਰਜਿਸ਼ ਹੋਏਗੀ ਅਤੇ ਉਹਦੇ ਨਾਲ ਅਸੀਂ ਆਪਣਾ ਵਜ਼ਨ ਘਟਾ ਸਕਦੇ ਹਾਂ ਇਸ ਲਈ ਇੱਕ ਚੰਗੇ ਭੰਗੜਾ ਐਰੋਬਿਕਸ ਲਈ ਸਾਨੂੰ ਇੱਕ ਵਧੀਆ ਗਾਣੇ ਦੀ ਔਰ ਇੱਕ ਅੱਛੇ ਜੋਸ਼ ਭਰੇ ਸਰੀਰ ਦੀ ਲੋੜ ਹੈ ਜਿਹਦੇ ਨਾਲ ਬੰਦਾ ਕੋਰੀਓਗ੍ਰਾਫੀ ਦੇ ਚਾਰ ਚੰਨ ਲਾ ਸਕਦਾ ਧੰਨਵਾਦ